ਮੈਨੂੰ ਲੱਗਦਾ ਪਟਿਆਲੇ ਅਤੇ ਇਹਦੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਤਿੰਨ ਸੌ ਤੋਂ ਪੰਜ ਸੌ ਦੇ ਕਰੀਬ ਜਿਹੜੇ ਡਾਕਟਰ ਹੈ ਅਤੇ ਪਟਿਆਲੇ ਦੇ ਵਿੱਚ ਜਿਹੜੇ ਪ੍ਰਾਈਵੇਟ ਅਤੇ ਸਰਕਾਰੀ ਜਿਹੜੇ ਹੋਸਪਿਟਲਜ਼ ਹੈ ਕੋਲਜ਼ ਹੈ ਜਿਵੇਂ ਰਜਿੰਦਰਾ ਮੈਡੀਕਲ ਕੋਲਜ਼ ਇਸ ਤੋਂ ਇਲਾਵਾ ਕਈ ਹੋਰ ਪ੍ਰਾਈਵੇਟ ਜਿਹੜੇ ਉਹ ਹੋਸਪਿਟਲ ਹੈ ਜੇ ਜਿੱਥੇ ਮਤਲਬ ਕਿ ਬੱਚਿਆਂ ਨੂੰ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ ਨਾਲ ਨਾਲ ਉਹਨਾਂ ਦੀ ਟ੍ਰੇਨਿੰਗ ਲਗਾਈ ਜਾਂਦੀ ਹੈ ਜਿੱਥੇ ਉਹ ਪੇਸ਼ੈਂਟ ਦਾ ਇਲਾਜ ਵੀ ਕਰਦੇ ਹੈ ਪਟਿਆਲੇ ਦੇ ਵਿੱਚ ਜਿਹੜੇ ਮਤਲਬ ਕਿ ਕਈ ਪ੍ਰਾਈਵੇਟ ਹੋਸਪਿਟਲਜ਼ ਵੀ ਹੈਗੇ ਨੇ ਜਿੱਥੇ ਬੱਚੇ ਆਪਣਾ ਐਕਸਪੈਰੀਮੈਂਟ ਕਰਦੇ ਆ ਹੌਲੀ ਹੌਲੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਦੀ ਜਿਹੜੀ ਮਤਲਬ ਕਿ ਟ੍ਰੇਨਿੰਗ ਲੱਗਦੀ ਹੈ ਉਹ ਰਿਸਰਚ ਕਰਦੇ ਨੇ ਅਤੇ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਵੀ ਉਹ ਦਿੰਦੇ ਨੇ